ਹਾਂਜੀ ਸਰ ਮੈਂ ਮੇਰਾ ਨਾਮ ਸ਼ੈਂਟੀ ਗੋਇਲ ਆ ਅਤੇ ਮੈਂ ਤੁਹਾਡੇ ਬੈਂਕ ਦਾ ਕਸਟਮਰ ਹਾਂ ਅਤੇ ਸਰ ਮੇਰਾ ਰੀਸੈਂਟਲੀ ਦੋ ਕੁ ਦਿਨ ਪਹਿਲਾਂ ਮੇਰੇ ਬੈਂਕ ਦੇ ਵਿੱਚੋਂ ਮੇਰੇ ਖਾਤੇ ਦੇ ਵਿੱਚੋਂ ਦਸ ਹਜ਼ਾਰ ਰੁਪਏ ਦੀ ਕਟੌਤੀ ਹੋਈ ਹੈ ਅਤੇ ਮੈਨੂੰ ਮੈਂ ਇਹੋ ਜਿਹਾ ਕੋਈ ਪੇਮੈਂਟ ਨਹੀਂ ਕਰੀ ਅਤੇ ਮੈਂ ਜਾਣਨਾ ਚਾਹੁੰਦਾ ਸੀਗਾ ਕਿ ਇਹ ਕਿਸ ਕਾਰਨ ਕਟੌਤੀ ਕੀਤੀ ਗਈ ਹੈ ਮੇਰਾ ਬੈਂਕ ਦਾ ਜਿਹੜਾ ਅਕਾਊਂਟ ਨੰਬਰ ਹੈ ਉਹ ਹੈ ਜੀ ਪੰਜ ਚਾਰ ਨੌ ਦੋ ਛੇ ਚਾਰ ਛੇ ਚਾਰ ਅੱਠ ਇੱਕ ਨੌ ਦੋ ਐਨ ਪੀ ਕਿਊ ਡੀ ਠੀਕ ਹੈ ਜੀ ਇਹ ਮੇਰਾ ਇੱਕ ਕਰੰਟ ਅਕਾਊਂਟ ਹੈ ਜੀ ਅਤੇ ਮੇਰਾ ਖੁਦ ਦਾ ਜਿਹੜਾ ਨੰਬਰ ਹੈ ਮੋਬਾਈਲ ਨੰਬਰ ਹੈ ਉਹ ਹੈ ਨੌ ਪੰਜ ਤਿੰਨ ਜ਼ੀਰੋ ਸੱਤ ਅੱਠ ਛੇ ਨੌ ਅੱਠ ਅੱਠ ਅਤੇ ਮੈਨੂੰ ਜਲਦੀ ਦੱਸੋ ਕਿ ਇਹ ਹੋਇਆ ਕਿਉਂ ਹੈ ਅਤੇ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਟੌਤੀ ਹੋਈ ਕਿੱਥੇ ਹੈ ਠੀਕ ਹੈ ਜੀ ਕਿਉਂਕਿ ਇਸ ਤੋਂ ਪਹਿਲਾਂ ਇਹੋ ਜਿਹੀ ਕੋਈ ਵੀ ਕਟੌਤੀ ਮੇਰੇ ਅਕਾਊਂਟ 'ਚੋਂ ਪਹਿਲਾਂ ਨਹੀਂ ਹੋਈ ਸੀ ਇਸ ਲਈ ਮੈਨੂੰ ਬੜਾ ਬੜਾ ਅਫਸੋਸ ਹੋਇਆ ਕਿ ਪਹਿਲੀ ਵਾਰ ਇਹੋ ਜਿਹੀ ਕੋਈ ਨਿਗਲੀਜੈਂਸ ਨਾ ਹੋਈ ਹੋਵੇ ਤੁਹਾਡੇ ਵੱਲੋਂ ਕਿ ਮੇਰੇ ਬੈਂਕ 'ਚੋਂ ਇਹੋ ਜਿਹੀ ਕਟੌਤੀ ਹੋ ਗਈ ਹੋਵੇ ਖਾਤੇ 'ਚੋਂ ਪਲੀਜ ਤਾਂ ਮੈਨੂੰ ਇਸ ਦੇ ਬਾਰੇ ਪੂਰੀ ਅਪਡੇਟ ਚਾਹੀਦੀ ਹੈ ਕਿ ਕੋਈ ਜਾਂ ਫਿਰ ਕੋਈ ਬੈਂਕ ਦਾ ਕੋਈ ਇਹੋ ਜਿਹਾ ਫੀਸ ਹੋਵੇ ਕੁਛ ਵੀ ਕੱਟੀ ਹੋਵੇ ਕਿਸ ਦੇ ਰਿਗਾਰਡਿੰਗ ਹੈ ਕਿੰਨੇ ਇਹ ਸਾਲ ਦੇ ਵਿੱਚ ਕਿੰਨੀ ਵਾਰ ਕੱਟਦੀ ਹੈ ਤਾਂ ਇਸ ਦੇ ਬਾਰੇ ਮੈਨੂੰ ਪੂਰਾ ਵੇਰਵਾ ਚਾਹੀਦਾ ਇਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਮੇਰੇ ਕੋਈ ਮੇਰੇ ਤੋਂ ਕੋਈ ਲੋੜ ਹੈ ਕੁਛ ਸਵਾਲ ਜਵਾਬ ਕਰਨ ਦੀ ਆਪਾਂ ਨੂੰ ਪੁੱਛ ਸਕਦੇ ਹੋ ਮੇਰੇ ਵੱਟਸਐਪ ਨੰਬਰ 'ਤੇ ਜੋ ਮੈਂ ਤੁਹਾਨੂੰ ਦਿੱਤਾ ਹੈ ਉਸ 'ਤੇ ਮੈਨੂੰ ਸੈਂਡ ਮੈਸੇਜ ਵੀ ਭੇਜ ਸਕਦੇ ਹੋ